ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਲਾ ਅਤੇ ਸ਼ਿਲਪੀਕਾਰੀ ਕੱਪੜਿਆਂ ਦੀਆਂ ਸਮੱਗਰੀਆਂ ਸਮੱਗਰੀਆਂ ਜਿਹੜੀਆਂ ਸਾਡੇ ਪੰਜਾਬੀ ਸੱਭਿਆਚਾਰ ਨੂੰ ਬਿਆਨ ਕਰਦੀਆਂ ਅਤੇ ਬਹੁਤ ਮਹੱਤਵਪੂਰਨ ਰੱਖਦੀਆਂ ਕਿਉਂਕਿ ਜਦੋਂ ਜਿਵੇਂ ਕਿ ਕੁੜੀਆਂ ਫਿਲ ਦੀਆਂ ਪਟਿਆਲਾ ਸੂਟ ਹੋ ਗਏ ਫੁਲਕਾਰੀਆਂ ਹੋ ਗਈਆਂ ਮੁੰਡਿਆਂ ਦੇ ਕੈਂਠੇ ਕੁੜੀਆਂ ਦੀਆਂ ਝਾਂਜਰਾ ਸੱਗੀ ਫੁੱਲ ਹੋ ਗਏ ਅਲੱਗ ਅਲੱਗ ਤਰ੍ਹਾਂ ਦੇ ਗਹਿਣੇ ਕੋਕੇ ਵਾਲ਼ੀਆਂ ਜਿਹੜੇ ਸਾਰੇ ਕੁੜੀਆਂ ਦੇ ਕੁੜੀਆਂ ਜਦੋਂ ਜਿਹੜੀਆਂ ਕੁੜੀਆਂ ਵਿਆਹੀਆਂ ਜਾਂਦੀਆਂ ਜਿਹੜੀ ਫੁਲਕਾਰੀ ਹੋ ਗਈ ਝਾਂਜਰਾ ਹੋ ਗਈਆਂ ਕੋਕੇ ਵਾਲ਼ੀਆਂ ਇਹ ਸ਼ਗਨ ਦੇ ਤੌਰ 'ਤੇ ਦਿੱਤੀਆਂ ਜਾਂਦੀਆਂ ਕਿਉਂਕਿ ਇਹ ਬਹੁਤ ਸ਼ੁੱਭ ਮੰਨੀਆਂ ਜਾਂਦੀਆਂ ਵਿਆਹੀਆਂ ਕੁੜੀਆਂ ਲਈ ਇਹ ਉਹਨਾਂ ਦੇ ਸੁਹਾਗ ਸੁਹਾਗਣ ਹੋਣ ਦਾ ਪ੍ਰਤੀਕ ਵੀ ਦਰਸਾਉਂਦੀਆਂ ਏ ਅਤੇ ਨਾਲ ਨਾਲ ਹੀ ਸਾਡੇ ਸੱਭਿਆਚਾਰ ਨੂੰ ਵੀ ਬਿਆਨ ਕਰਦੀ ਏ ਕਿ ਕਿਵੇਂ ਦਾ ਸਭਿਆਚਾਰ ਹੈ ਪੰਜਾਬ ਦਾ ਅਤੇ ਬਹੁਤ ਸਾਰੇ ਮੁੰਡੇ ਆ ਜਿਹੜੇ ਕੁੜਤਾ ਪਜਾਮਾ ਪੱਗ ਬ ਪੱਗਾਂ ਬੰਨਦੇ ਅਤੇ ਗਲ 'ਚ ਕੈਂਠੇ ਪਾਉਂਦੇ ਆਪਣੇ ਵਿਆਹਾਂ 'ਤੇ ਆਪਣੇ ਸੱਭਿਆਚਾਰ ਨੂੰ ਬਿਆਨ ਕਰਦੇ ਹੈ ਬਹੁਤ ਸਾਰੀਆਂ ਅਲੱਗ ਅਲੱਗ ਕੁੜੀਆਂ ਏ ਜਿਹੜੀਆਂ ਅਲੱਗ ਅਲੱਗ ਤਰ੍ਹਾਂ ਦੇ ਸੂਟ ਪਾਉਂਦੀਆਂ ਡਰੈੱਸਜ਼ ਹੁੰਦੀਆਂ ਡਰੈੱਸਜ਼ ਅਲੱਗ ਅਲੱਗ ਤਰ੍ਹਾਂ ਦੀਆਂ ਅਤੇ ਜਦੋਂ ਤਿਆਰ ਹੁੰਦੀਆਂ ਚੂੜੀਆਂ ਪਾ ਕੇ ਝਾਂਜਰਾਂ ਪਾ ਕੇ ਵਾਲ਼ੀਆਂ ਕੋਕੇ ਜਦੋਂ ਸੁਣ ਸੱਗੀ ਫੁੱਲ ਲਗਾ ਕੇ ਸੋਹਣੀਆਂ ਜਿਹੀਆਂ ਤਿਆਰ ਹੁੰਦੀਆਂ ਅਲੱਗੇ ਪੰਜਾਬੀ ਮੁਟਿਆਰਾਂ ਲੱਗਦੀਆਂ ਏ ਅਤੇ ਮੁੰਡਿਆਂ ਅੱਜ ਕੱਲ੍ਹ ਜਦੋਂ ਵੀ ਕੋਈ ਵੀ ਕਿਸ ਕਿਸੇ ਖਾਸ ਮੌਕੇ 'ਤੇ ਜਿਵੇਂ ਕਿ ਕੋਈ ਵੀ ਗਿੱਧਾ ਭੰਗੜਾ ਹੁੰਦਾ ਏ ਤਾਂ ਇਹਨਾਂ ਵਿੱਚ ਕੁੜੀਆਂ ਏ ਜਿਹੜੀਆਂ ਇਹ ਸੋਹਣੀਆਂ ਸੋਹਣੀਆਂ ਘੱਗਰੇ ਪਾਉਂਦੀਆਂ ਗਿੱਧੇ ਲਈ ਮੁੰਡੇ ਕੁੜਤੇ ਪਜਾਮੇ ਪਾਉਂਦੇ ਅਤੇ ਅਲੱਗ ਹੀ ਨਿਖਰ ਕੇ ਆਉਂਦਾ ਪੰਜਾਬੀ ਮਟਿਆਰਾਂ ਦਾ ਰੂਪ